ਮੈਂ ਅਕਸਰ ਲਾਈਬ੍ਰੇਰੀ ਵਿੱਚ ਜਾ ਕੇ ਬਹੁਤ ਸਾਰੀਆਂ ਕਿਤਾਬਾਂ ਪੜ੍ਹਦੀ ਹਾਂ ਉਹਨਾਂ ਕਿਤਾਬਾਂ ਵਿੱਚੋਂ ਮੇਰਾ ਮਨਪਸੰਦ ਕਿਤਾਬ ਦਾ ਹਵਾਲਾ ਹੈ ਜਨਮ ਸਾਖੀਆਂ ਜਨਮ ਸਾਖੀਆਂ ਕਿਤਾਬ ਵਿੱਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਦੱਸਿਆ ਗਿਆ ਹੈ ਕਿਵੇਂ ਗੁਰੂ ਨਾਨਕ ਦੇਵ ਜੀ ਨੇ ਆਪਣਾ ਸਾਰਾ ਜੀਵਨ ਮਨੁੱਖਾਂ ਲਈ ਸਮਰਪਿਤ ਕਰ ਦਿੱਤਾ ਕਿਵੇਂ ਉਹ ਬੁਰਾਈ ਹੁੰਦੇ ਨਹੀਂ ਦੇਖ ਸਕਦੇ ਸਨ ਜਿੱਥੇ ਵੀ ਉਹ ਬੁਰਾਈ ਹੁੰਦੇ ਦੇਖਦੇ ਸਨ ਉੱਥੇ ਹੀ ਉਹ ਖੜ੍ਹ ਜਾਂਦੇ ਸਨ ਅਤੇ ਬੁਰਾ ਨਹੀਂ ਸੀ ਹੋਣ ਦਿੰਦੇ ਇਵੇਂ ਹੀ ਮੈਂ ਆਪਣੇ ਜੀਵਨ ਵਿੱਚ ਜਦ ਕਦੀ ਵੀ ਬੁਰਾ ਹੁੰਦੇ ਦੇਖਦੀ ਹਾਂ ਤਾਂ ਮੈਂ ਵੀ ਸਹਿਣ ਨਹੀਂ ਕਰ ਸਕਦੀ ਮੈਂ ਅਕਸਰ ਉੱਥੇ ਖੜ੍ਹ ਜਾਂਦੀ ਹਾਂ ਅਤੇ ਬੁਰਾਈ ਨੂੰ ਰੋਕਦੀ ਹਾਂ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਕਈ ਸਾਰੀਆਂ ਉਦਾਸੀਆਂ ਕੀਤੀਆਂ ਅਤੇ ਮਨੁੱਖਾਂ ਨੂੰ ਸਿੱਧੇ ਰਾਹ ਪਾਇਆ ਜਿਸ ਵਿੱਚ ਗੁਰੂ ਨਾਨਕ ਦੇਵ ਜੀ ਨੇ ਬਹੁਤ ਸਾਰੀਆਂ ਚੰਗਿਆਈਆਂ ਦਾ ਵਰਣਨ ਕੀਤਾ ਅਤੇ ਬੁਰਾਈਆਂ ਨੂੰ ਦੂਰ ਕੀਤਾ ਧੰਨਵਾਦ